ਸੁਰੱਖਿਅਤ ਲਈ ਇੱਕ ਅੱਛਾ ਹੈਲਮੇਟ ਪਹਿਨਣਾ ਬਹੁਤ ਜ਼ਰੂਰੀ ਹੈ ਜੋ ਤੁਹਾਨੂੰ ਚੋਟਾਂ ਤੋਂ ਬਚਾਉਂਦਾ ਹੈ ਅੱਛੀ ਰੌਸ਼ਨੀ ਵੇ ਰੌਸ਼ਨੀ ਅਤੇ ਰਿਫਲੈਕਟਰ ਰਾਤ ਦੇ ਸਮੇਂ ਜਾਂ ਥੋੜ੍ਹੀ ਰੋਸ਼ਨੀ ਵਿੱਚ ਸਾਈਕਲ ਚਲਾਉਂਦੇ ਸਮੇਂ ਪ੍ਰਜੇਪਤਾ ਪ੍ਰਜਪਤਾ ਰੌਸ਼ਨੀ ਅਤੇ ਰਿਫਲੈਕਟਰ ਲਾਉਣ ਲਗਾਉਣਾ ਜ਼ਰੂਰੀ ਹੈ ਜਾਂ ਜੋ ਕਿ ਦੂਜੇ ਯਾਤਰੀ ਨੂੰ ਦਿੱਖ ਸਕਣ ਟਰੈਫਕ ਦੇ ਨਿਯਮਾਂ ਦੀ ਪਾਲਣਾ ਕਰੋ ਸੜਕ ਉੱਤੇ ਸਾਈਕਲ ਚਲਾਉਂਦੇ ਸਮੇਂ ਟਰੈਫਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਜਿਹੜੇ ਇਸ਼ਾਰੇ ਲੱਗੇ ਹੋਣ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਅਤੇ ਲਾਲ ਬੱਤੀ ਅਤੇ ਰੁਕਣਾ ਸਾਈਕਲ ਦੀ ਮੁਰੰਮਤ ਅਤੇ ਸੰਭਾਲ ਆਪਣੀ ਸਾਈਕਲ ਨੂੰ ਸਹੀ ਤਰੀਕੇ ਦੇ ਨਾਲ ਮੁਰੰਮਤ ਅਤੇ ਟਾਇਰ ਦੀ ਹਵਾ ਜਾਂਚ ਯੰਤਰ ਤੋਂ ਪਹਿਲਾਂ ਬਹੁਤ ਹੀ ਜ਼ਰੂਰੀ ਹੈ ਸਥਾਨਿਕ ਹਵਾਲੇ ਦੇ ਨਾਲ ਜਾਣੂ ਰਹੋ ਜਿੱਥੇ ਤੁਸੀਂ ਸਾਈਕਲ ਚਲਾ ਰਹੇ ਹੋ ਉਸ ਜਗ੍ਹਾ 'ਤੇ ਉਸ ਇਲਾਕੇ ਅਤੇ ਸੜਕਾਂ ਦੇ ਬਾਰੇ ਜਾਣਕਾਰੀ ਰੱਖੋ ਜਿਵੇਂ ਕਿ ਕਿਸੇ ਖਤਰੇ ਵਾਲੀ ਜਗ੍ਹਾ ਜਾਂ ਸ਼ੁਕ ਸ਼ੁਕ ਚਿੰਤਾ ਸੜਕ ਬਾਰੇ ਯਾਤਰਾ ਸਮੇਂ ਯਾਤਰਾ ਦੌਰਾਨ ਜਿਹੜੇ ਦਸਤਾਵੇਜ਼ ਆਪਣੇ ਨਾਲ ਰੱਖਣੇ ਚਾਹੀਦੇ ਹਨ ਆਈਡੀ ਪ੍ਰੂਫ ਅਤੇ ਆਈਡੀ ਪ੍ਰੂਫ ਆਪਣੀ ਪਹਿਚਾਣ ਸਾਬਤ ਕਰਨ ਵਾਲਾ ਦਸਤਾਵੇਜ਼ ਹੈ ਜਿਵੇਂ ਕਿ ਆਧਾਰ ਕਾਰਡ ਜਾਂ ਪਾਸਪੋਰਟ ਰੱਖਣਾ ਅੱਛਾ ਹੁੰਦਾ ਹੈ ਪ੍ਰਥਮ ਸਹਾਇਤਾ ਛੋਟੀਆਂ ਹਾਦਸਿਆਂ ਜਾਂ ਸਹਾਇਤਾ ਨਾਲ ਜ਼ਰੂਰੀ ਜ਼ਰੂਰਤ ਪੈਣ 'ਤੇ ਇੱਕ ਛੋਟਾ ਪ੍ਰਥਮ ਸਹਾਇਕ ਰੱਖਣਾ ਜ਼ਰੂਰੀ ਰੱਖਣਾ ਇਨਸ਼ੋਰੈਂਸ ਜਾਣਕਾਰੀ ਜਿਵੇਂ ਕਿ ਹਰ ਸਮਰੱਥਾ ਹਾਦਸੇ ਵਿੱਚ ਮਦਦ ਵੀ ਮਦਦ ਲਈ ਆਪਣੇ ਇਨਸ਼ੋਰੈਂਸ ਦੇ ਬਾਰੇ ਜਾਣਕਾਰੀ ਰੱਖਣਾ ਮੋਬਾਈਲ ਫੋਨ ਮਦਦ ਲਈ ਜਾਂ ਐਮਰਜੈਂਸੀ ਦੇ ਨਾਲ ਸੰਪਰਕ ਕਰਨ ਲਈ ਮੋਬਾਈਲ ਫੋਨ ਨਾਲ ਰਹੋ